ਕਈ ਲੋਕ ਸਵੇਰੇ ਉੱਠ ਕੇ ਗਰਮ ਪਾਣੀ ਪੀਂਦੇ ਹਨ ਅਤੇ ਕਈ ਲੋਕ ਸਵੇਰੇ ਸੈਰ ਕਰਨ ਲਈ ਜਾਂਦੇ ਹਨ ਜੋ ਕਿ ਉਹਨਾਂ ਦੇ ਭਾਰ ਘਟਾਉਣ ਵਿੱਚ ਬਹੁਤ ਹੀ ਮਹੱਤਵਪੂਰਨ ਸਹਾਇਤਾ ਕਰਦੀ ਹੈ ਕਈ ਲੋਕ ਸਾਡੇ ਪਿੰਡ ਵਿੱਚ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਂਦੇ ਹਨ ਅਤੇ ਰਾਤ ਨੂੰ ਵੀ ਖਾਣਾ ਖਾਣ ਤੋਂ ਬਾਅਦ ਉਹ ਸੈਰ ਲਈ ਜਾਂਦੇ ਹਨ ਕਈ ਲੋਕ ਆਪਣੇ ਭਾਰ ਘਟਾਉਣ ਲਈ ਯੋਗਾ ਅਤੇ ਕਸਰਤ ਆਦਿ ਦਾ ਵੀ ਸਹਾਰਾ ਲੈਂਦੇ ਹਨ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਹਨ ਅਤੇ ਇਹ ਭਾਰ ਘਟਾਉਣ ਵਿੱਚ ਵੀ ਬਹੁਤ ਹੀ ਜ਼ਿਆਦਾ ਸਹਾਇਤਾ ਕਰਦੇ ਹਨ ਕਈ ਲੋਕ ਰਾਤ ਨੂੰ ਇੱਕ ਗਲਾਸ ਵਿੱਚ ਮੇਥੀ ਦੇ ਦਾਣੇ ਭਿਗੋ ਕੇ ਰੱਖ ਦਿੰਦੇ ਹਨ ਅਤੇ ਸਵੇਰੇ ਉੱਠ ਕੇ ਉਸ ਪਾਣੀ ਨੂੰ ਪਾਣੀ ਦਾ ਸੇਵਨ ਕਰਦੇ ਹਨ ਅਤੇ ਕਈ ਲੋਕ ਉਸ ਮੇਥੀ ਦੇ ਦਾਣੇ ਨੂੰ ਖਾਂਦੇ ਵੀ ਹਨ ਤਾਂ ਕਿ ਉਹਨਾਂ ਦਾ ਜੋ ਵੀ ਅੰਦਰ ਕੈਲੋਸਟ੍ਰੋਲ ਵਧਿਆ ਹੋਇਆ ਹੈ ਉਹ ਘਟਾਉਣ ਦੇ ਕੰਮ ਆ ਜਾਵੇ ਔਰ ਜਿਸ ਨਾਲ ਸਾਡੀ ਚਰਬੀ ਵੀ ਪਿਘਲਦੀ ਹੈ ਇਹ ਜ਼ਿਆਦਾ ਤੋਂ ਜ਼ਿਆਦਾ ਲੋਕ ਵਰਤੋਂ ਵਿੱਚ ਲੈ ਕੇ ਆਉਂਦੇ ਹਨ ਕਈ ਲੋਕ ਸਾਡੇ ਪੱਛਮੀ ਦੇਸ਼ਾਂ ਦੇ ਪ੍ਰਚਾਰ ਕਰਨ ਲਈ ਗਰੀਨ ਟੀ ਦੀ ਵੀ ਵਰਤੋਂ ਕਰਦੇ ਹਨ ਔਰ ਕਈ ਲੋਕ ਤਾਂ ਆਪਣਾ ਜੋ ਵੀ ਖਾਣਾ ਖਾ ਕੇ ਬਸ ਇੱਕ ਸੈਰ ਅਤੇ ਕਸਰਤ ਆਦਿ ਦਾ ਸਹਾਰਾ ਲੈਂਦੇ ਹਨ ਜੋ ਕਿ ਉਹਨਾਂ ਦੇ ਭਾਰ ਘਟਾਉਣ ਵਿੱਚ ਕੰਮ ਆਉਂਦਾ ਹੈ ਔਰ ਉਹਨਾਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਇਹ ਕਰਦੇ ਹਨ ਕਿ ਉਹ ਜ਼ਿਆਦਾ ਓਇਲੀ ਜਾਂ ਫਾਸਟ ਫੂਡ ਖਾਣਾ ਬੰਦ ਕਰ ਦਿੰਦੇ ਹਨ ਜਿਨ੍ਹਾਂ ਕਰਕੇ ਕਿ ਉਹਨਾਂ ਦਾ ਭਾਰ ਘਟਣ ਵਿੱਚ ਬਹੁਤ ਹੀ ਜ਼ਿਆਦਾ ਆਸਾਨੀ ਹੁੰਦੀ ਹੈ ਧੰਨਵਾਦ